ਜਾਨਵਰਾਂ ਨਾਲ ਮੇਰਾ ਰਿਸ਼ਤਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜਾਨਵਰ ਬੇਜਵਾਨ ਹਨ

ਨੂੰ ਟਾਈਮ ਅਨੁਸਾਰ ਖੁਰਾਕ ਦੇਣੀ ਚਾਹੀਦੀ ਹਨ ਕਿਉਂਕਿ ਜਾਨਵਰ ਜਿਵੇਂ ਕਿ ਉਹਨਾਂ ਦੇ ਨਾਂ ਮੱਝ ਗਾਂ ਮੁਰਗੀਆਂ ਇਹ ਬੋਲ ਨਹੀਂ ਸਕਦੀਆਂ ਇਹਨਾਂ ਨੂੰ ਟਾਈਮ ਦੇ ਅਨੁਸਾਰ ਖੁਰਾਕ ਦੇਣੀ ਚਾਹੀਦੀ ਹੈ ਮੈਂ ਮੇਰਾ ਕਿੱਤਾ ਡੇਅਰੀ ਫਾਰਮਿੰਗ ਅਤੇ ਪੋਲਟਰੀ ਦਾ ਹੈ ਇਸ ਲਈ ਮੈਂ ਇਹਨਾਂ ਦੀ ਦੇਖਭਾਲ ਚੰਗੀ ਤਰ੍ਹਾਂ ਕਰਦਾ ਹਾਂ

ਤੇ ਉਹਨਾਂ ਦੀ ਸਿਹਤ ਇਵੇਂ ਕਿ ਜਦੋਂ ਬਿਮਾਰ ਹੁੰਦੇ ਹਨ ਉਹਨਾਂ ਦੀ ਵੈਕਸੀਨੇਸ਼ਨ ਵਗੈਰਾ ਟਾਈਮ ਸਿਰ ਕਰਵਾਉਂਦਾ ਹਾਂ ਤਾਂ ਜੋ ਉਹ ਸਾਡੇ ਰੁਜ਼ਗਾਰ ਨੂੰ ਵੀ ਵੱਧ ਉਤਸਾਹ ਦੇ ਸਕਣ ਧੰਨਵਾਦ